ਸਾਡੇ ਖੇਤਰ ਦੇ ਮੁੱਖ ਧਾਰਮਿਕ ਪਰੰਪਰਾਵਾਂ ਵਾ ਇਹਨਾਂ ਦੀ ਜਿੱਤ 'ਚ ਇਤਿਹਾਸ ਕਿਹਾ ਇੱਦਾਂ ਵਾਂ ਵੀ ਗੁਰੂ ਗੁ ਸਾਹਿਬਾਨਾਂ ਨਾਲ ਜਿਹੜੇ ਜਨਮ ਦਿਹਾੜੇ ਉਹ ਮਨਾਏ ਜਾਂਦੇ ਆ ਜਾਂ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ ਆ ਜਿਹਦੇ ਜਨਮ ਦਿਹਾੜੇ ਮਨਾਉਂਦੇ ਆ ਅਤੇ ਤਾਂ ਵੀ ਲੋਕ ਬੜੇ ਇਕੱਠੇ ਹੁੰਦੇ ਆ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਅਤੇ ਉੱਥੇ ਬੜੇ ਵਧੀਆ ਤਰੀਕੇ ਨਾਲ ਨਗਰ ਕੀਰਤਨ ਕੱਢਿਆ ਜਾਂਦਾ ਆ ਜਿਹਦੇ ਵਿੱਚ ਸ ਨਗਰ ਦੀਆਂ ਪੂਰੀਆਂ ਸੰਗਤਾਂ ਹੁੰਦੀਆਂ ਵਾਂ ਅਤੇ ਵੱਖਰੇ ਵੱਖਰੇ ਪੜਾਅ ਹੁੰਦੇ ਆ ਪੂਰੇ ਦਿਨ ਦਾ ਪ੍ਰੋਗਰਾਮ ਬਣਾਉਂਦੇ ਆ ਕਈ ਵਾਰ ਜਿਹੜੇ ਦੂਜੇ ਧਰਮ ਆ ਜਿਵੇਂ ਹਿੰਦੂ ਧਰਮ ਆ ਜਾਂ ਮੁਸਲਮਾਨ ਧਰਮ ਆ ਉਹਨਾਂ ਦੇ ਵੀ ਪ੍ਰੋਗਰਾਮ ਮਨਾਏ ਜਾਂਦੇ ਆ ਉਹਨਾਂ ਦੇ ਵਿੱਚ ਸੰਗਤਾਂ ਸਾਰੀਆਂ ਹਿੱਸੇ ਲੈਂਦੀਆਂ ਬਾਕੀ ਸਾਡੇ ਇੱਧਰ ਏਰੀਏ ਦੇ ਵਿੱਚੋਂ ਜ਼ਿਆਦਾਤਰ ਲੋਕ ਜਿੱਦਾਂ ਯਾਤਰਾ ਜਾਂਦੇ ਆ ਆਨੰਦਪੁਰ ਸਾਹਿਬ ਦੀ ਯਾਤਰਾ ਜਾਂਦੇ ਹੋਲੇ ਮਹੱਲੇ ਦੇ ਉੱਤੇ ਜਾਂ ਹੇਮਕੁੰਟ ਸਾਹਿਬ ਦੀ ਯਾਤਰਾ ਜਾਂਦੇ ਆ ਕਈ ਲੋਕ ਹਰ ਹਜ਼ੂਰ ਸਾਹਿਬ ਦੀ ਯਾਤਰਾ ਜਾਂਦੇ ਆ ਕਿਉਂਕਿ ਉਹ ਸਿੱਖਾਂ ਦਾ ਪੰਜਵਾਂ ਤਖਤ ਆ ਉਹਦੇ ਹਿਸਾਬ ਨਾਲ ਜਿਵੇਂ ਮਾਘੀ ਦਾ ਮੇਲਾ ਵਾ ਉਹ ਮੁਕਤਸਰ ਸਾਹਿਬ ਮਨਾਇਆ ਜਾਂਦਾ ਅਤੇ ਦਿਵਾਲੀ ਜਿਹੜੀ ਉਹ ਅੰਮ੍ਰਿਤਸਰ ਮਨਾਈ ਜਾਂਦੀ ਜ਼ਿਆਦਾਤਰ ਇਹ ਸਾਰੇ ਧਾਰਮਿਕ ਪ੍ਰੰਪਰਾਵਾਂ ਵਾ ਧਾਰਮਿਕ ਰੀਤੀ ਰਿਵਾਜ ਆ ਉਹਦੇ ਹਿਸਾਬ ਨਾਲ ਯਾਤਰਾ ਲੋਕ ਕਰਦੇ ਆ ਅਤੇ ਪੂਰੇ ਸਾਲ ਦੇ ਵਿੱਚ ਜਿਹੜੇ ਉਹ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਵਾ